ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਟੋ ਸਟੇਸ਼ਨ ਤੋਂ ਗੱਲ ਕਰ ਰਹੇ ਹੋ ਜੀ ਮੇਰਾ ਨਾਮ ਹਰਪ੍ਰੀਤ ਹੈ ਜੀ ਅਤੇ ਮੈਂ ਪਿੰਡ ਬਾਰਨ ਸਰਹੰਦ ਰੋਡ ਪਟਿਆਲੇ ਤੋਂ ਗੱਲ ਕਰ ਰਿਹਾ ਹਾਂਜੀ ਹਾਂਜੀ ਉਹ ਜਿਹੜਾ ਆਪਣੇ ਸਰਹੰਦ ਰੋਡ 'ਤੇ ਪੰਜ ਸੱਤ ਕਿਲੋਮੀਟਰ ਪੈਂਦਾ ਪਟਿਆਲੇ ਸ਼ਹਿਰ ਤੋਂ ਜੀ ਜੀ ਹਾਂਜੀ ਮੈਂ ਰਾਤ ਨੂੰ ਸ਼ਾਮ ਨੂੰ ਨਾ ਸੱਤ ਕੁ ਵਜੇ ਪਟਿਆਲੇ ਜਾਣਾ ਅਤੇ ਉੱਥੋਂ ਮੈਂ ਟ੍ਰੇਨ ਲੈ ਕੇ ਅੱਗੇ ਜਾਣਾ ਯੂਪੀ ਵੱਲ ਅਤੇ ਤੁਸੀਂ ਆਟੋ ਆਪਣਾ ਪੌਣੇ ਕੁ ਸੱਤ ਵਜੇ ਬਾਰਨ ਭੇਜ ਸਕਦੇ ਹੋ ਜੀ ਜੀ ਕਰ ਲਉ ਜੀ ਪਤਾ ਹਾਂਜੀ ਅਤੇ ਬੰਦਾ ਮੇਰੇ ਕੋਲ ਆ ਜਾਵੇ ਟਾਈਮ ਟੂ ਟਾਈਮ ਕਿਉਂਕਿ ਮੇਰੀ ਸਵਾ ਸੱਤ ਵਜੇ ਟ੍ਰੇਨ ਹੈ ਜੇ ਮੈਂ ਸੱਤ ਵਜੇ ਸਟੇਸ਼ਨ ਪਹੁੰਚੂਗਾ ਤਾਂ ਮੈਂ ਉੱਥੇ ਟਿਕਟ ਲੈ ਕੇ ਆਪਣੇ ਟਾਈਮ 'ਤੇ ਆਪਣੇ ਮੈਂ ਡੱਬੇ ਵਿੱਚ ਬੈਠ ਸਕਦਾ ਕਿਰਪਾ ਕਰਕੇ ਟਾਈਮ 'ਤੇ ਬੰਦਾ ਆ ਜਾਵੇ ਅਤੇ ਜਿਹੜੇ ਪੈਸੇ ਨੇ ਤੁਸੀਂ ਮੈਨੂੰ ਦੱਸ ਦਿਓ ਉਹਦੇ ਕਿੰਨੇ ਬਣਦੇ ਨੇ ਜੇ ਤੁਸੀਂ ਕਹੋ ਮੈਂ ਔਨਲਾਈਨ ਪੇਮੈਂਟ ਕਰ ਦੂਗਾ ਜੇ ਕੈਸ਼ ਲੈਣੇ ਨੇ ਤਾਂ ਮੈਂ ਕੈਸ਼ ਦੇ ਦੂਗਾ ਜੀ ਬਸ ਐਂ ਜੀ ਮੇਰੇ ਕੋਲ ਦੋ ਤੋਂ ਤਿੰਨ ਟੈਚੀਜ਼ ਹੋਣਗੀਆਂ ਅਤੇ ਜਿਹੜਾ ਵੀ ਮਤਲਬ ਬੰਦਾ ਤੁਸੀਂ ਭੇਜੋ ਕੋਈ ਵੀ ਨਸ਼ਾ ਪੱਤਾ ਕਿਸੇ ਪ੍ਰਕਾਰ ਦਾ ਕਰਦਾ ਨਾ ਹੋਵੇ ਕਿਉਂਕਿ ਨਾਲ ਮੇਰੇ ਵਾਈਫ ਨੇ ਅਤੇ ਦੋ ਬੱਚੇ ਵੀ ਨੇ ਅਤੇ ਤੁਸੀਂ ਕਿਰਪਾ ਕਰਕੇ ਐਨ ਆਪਣੀ ਜ਼ਿੰਮੇਵਾਰੀ ਨਾਲ ਭੇਜਿਓ ਅਤੇ ਅੱਗੇ ਵਾਸਤੇ ਵੀ ਅਸੀਂ ਤੁਹਾਡੇ ਤੋਂ ਸਰਵਿਸ ਲੈਂਦੇ ਰਹੀਏ ਅਤੇ ਜਦੋਂ ਮੈਂ ਵਾਪਸੀ 'ਤੇ ਆਉਣਾ ਫਿਰ ਵੀ ਮੈਂ ਤੁਹਾਨੂੰ ਆਪਣਾ ਜ਼ਿੰਮੇਵਾਰੀ ਨਾਲ ਫੋਨ ਕਰ ਸਕਾਂ ਅਤੇ ਇਸ ਵਿਵਸਥਾ ਨਾਲ ਤੁਸੀਂ ਬੰਦਾ ਭੇਜ ਦਿਓ ਅਤੇ ਮੈਂ ਹੁਣ ਸਾ ਸਾਢੇ ਪੰਜ ਹੋ ਗਏ ਮੈਂ ਤੁਹਾਡੀ ਵੇਟ ਕਰੂੰਗਾ ਜੀ ਅਤੇ ਪੌਣੇ ਸੱਤ ਵਜੇ ਬੰਦਾ ਤੁਸੀਂ ਜ਼ਰੂਰ ਭੇਜ ਦਿਓ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ